ਸਾਡੇ ਖੇਤਰਾਂ ਵਿੱਚ ਬਹੁਤ ਸਾਰੇ ਕੁਦਰਤੀ ਸਰੋਤ ਹੈ ਜਿਸ ਵਿੱਚ ਇੱਕ ਖੇਤੀਬਾੜੀ ਹੈ ਅਤੇ ਖੇਤੀਬਾੜੀ ਨੂੰ ਅੰਗਰੇਜ਼ੀ ਵਿੱਚ ਐਗਰੀਕਲਚਰ ਕਹਿੰਦੇ ਹੈ ਇਸ ਖੇਤੀ ਦਾ ਵਿਗਿਆਨ ਜਾਂ ਅਭਿਆਸ ਜਿਸ ਵਿੱਚ ਫ਼ਸਲਾਂ ਦੇ ਉਗਾਉਣ ਲਈ ਮਿੱਟੀ ਵੀ ਕਾਸ਼ਤ ਅਤੇ ਭੋਜਨ ਉਸ ਅਤੇ ਹੋਰ ਉਤਪਾਦਕ ਪ੍ਰਦਾਨ ਕਰਨ ਲਈ ਪਾਉਂਦੀਆਂ ਅਤੇ ਜਾਨਵਰਾਂ ਦੀ ਪਾ ਪਾਲਣ ਪੋਸ਼ਣ ਸ਼ਾਮਿਲ ਹਨ ਖੇਤੀਬਾੜੀ ਅਜਿਹੀ ਕਿਰਿਆ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਕੀਤੀ ਜਾਂਦੀ ਹੈ ਖੇਤੀਬਾੜੀ ਵਿੱਚ ਫ਼ਸਲਾਂ ਅਤੇ ਪਸ਼ੂਆਂ ਦੇ ਉਪ ਉ ਉਤਪਾਦਨ ਪਸ਼ੂ ਪਾਲਣ ਜਲ ਖੇਤੀ ਮੱਛੀ ਪਾਲਣ ਅਤੇ ਭੋਜਨ ਅਤੇ ਗੈਰ ਭੋਜਨ ਉਤਪਾਦਕਾਂ ਲਈ ਜਲ ਗਾਂਤ ਸ਼ਾਮਿਲ ਹਨ ਮਨੁੱਖੀ ਸੱਭਿਅਤਾ ਸੱਭਿਅਤਾ ਦੇ ਉਪਭਾਗ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ ਜਿਸ ਨਾਲ ਪਾਲਤੂ ਨਸਲਾਂ ਦੀ ਖੇਤੀ ਅਤੇ ਵਾਧੂ ਭੋਜਨ ਪੈਦਾ ਕੀਤਾ ਜਿਸ ਨਾਲ ਲੋਕਾਂ ਨੂੰ ਸ਼ਹਿਰਾਂ ਵਿੱਚ ਰਹਿਣਾ ਅਤੇ ਯੋਗ ਬਣਾਇਆ ਗਿਆ ਖੇਤੀਬਾੜੀ ਦੇ ਅਧਿਐਨ ਨੂੰ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ